ਹੈਲੋ ਹਾਂਜੀ ਹਾਂਜੀ ਵੀਰੇ ਬਸ ਵੀਰਾ ਜੀ ਵਧੀਆ ਤੁਸੀਂ ਦੱਸੋ

ਅੱਛਾ ਅੱਛਾ ਹਾਂਜੀ ਹਾਂਜੀ ਅੱਛਾ ਤੁਸੀਂ ਉੱਥੋਂ ਹੋਸਟਲ ਨਹੀਂ ਦੇਖਿਆ ਹੈਗਾ ਅੱਛਾ ਵੀਰੇ ਦੇਖ ਇੱਕ ਤਾਂ ਹੈਗਾ ਤੁਹਾਨੂੰ ਫੇਸ ਟੂ ਮਿਲ ਜਾਣਾ ਪੀ ਜੀ ਅਤੇ ਹਾਂ ਉਹਦੇ ਵਿੱਚ ਮਤਲਬ ਸਾਰਾ ਕੋਈ ਐਂਟਰੀ ਦੀ ਰਿਸਟਿਕਸ਼ਨ ਨਹੀਂ ਹੋਣੀ ਚੌਵੀ ਘੰਟੇ ਖੁੱਲਾ ਹੋਊ ਜਦੋਂ ਮਰਜ਼ੀ ਆਓ ਜਾਓ ਅਤੇ ਰਹਿਣ ਸਹਿਣ ਨੂੰ ਤੁਹਾਡਾ ਬਿਜਲੀ ਦਾ ਖ਼ਰਚਾ ਅੱਡ ਹੋਊਗਾ ਖਾਣ ਪੀਣ ਦਾ ਖ਼ਰਚਾ ਤੁਹਾਨੂੰ ਬਾਹਰੋਂ ਕਰਨਾ ਪੈਣਾ ਉਹ ਖ਼ਰਚਾ ਵਿੱਚ ਇਨਕਲੂਡ ਨਹੀਂ ਕਰਦੇ ਇਹ ਹਾਂ ਖਾਣ ਪੀਣ ਦਾ ਤੁਹਾਨੂੰ ਆਪ ਏ ਕਰਨਾ ਪੈਣਾ ਬਿਜਲੀ ਦਾ ਖ਼ਰਚਾ ਵੀ ਤੁਹਾਡਾ ਅੱਡ ਆਊਗਾ ਜਿਹੜਾ ਬਿਲ ਆਊਗਾ ਅਤੇ ਰਹਿਣ ਦਾ ਤੁਹਾਡਾ ਰੈਂਟ ਆਊਗਾ ਤੁਹਾਨੂੰ ਆਪ ਦੇਣਾ ਪੈਣਾ ਹਾਂ ਉਹ 'ਚ ਚੜਦੇ ਮਹੀਨੇ ਫੇਸ ਟੂ ਤੋਂ ਤੁਸੀਂ ਜਾਓਗੇ ਜਦੋਂ ਤੁਹਾਨੂੰ ਮੇ ਚੜਦੇ ਮਹੀਨੇ ਤੁਹਾਨੂੰ ਉਹ ਹੋਊਗਾ ਛੇ ਕੁ ਹਜ਼ਾਰ ਰੁਪਇਆ ਰੈਂਟ ਪੈ ਜਾਣਾ ਤੁਹਾਨੂੰ ਉਹ ਤੁਸੀਂ ਬਾਕੀ ਗੱਲਬਾਤ ਕਰਲਿਓ ਘਟਾ ਕੇ ਪਚਵੰਜਾ ਸੋ ਪੰਜ ਹਜ਼ਾਰ ਕਰ ਲੈਂਦੇ ਹੁੰਦੇ ਹੈ ਅਤੇ ਹਾਂ ਉਸ ਤੋਂ ਬਾਅਦ ਬਾਕੀ ਤੁਸੀਂ ਦੇਖੋ ਜੇ ਤੁਹਾਨੂੰ ਕਿਹਾ ਕਹੇ ਤਾਂ ਯੂਨੀਵਸਟੀ ਦੇ ਸਾਹਮਣੇ ਇਲਾਕਾ ਹੈਗਾ ਵਾਲੀਆ ਇਨਕਲੇਵ ਕਰਕੇ ਹੈ ਇੱਥੇ ਜਮਾਂ ਹੀ ਨਾਲ ਯੂਨੀਵਸਟੀ ਦੇ ਸਾਹਮਣੇ ਤੁਸੀਂ ਉੱਥੇ ਦੇਖ ਸਕਦੇ ਹੋ ਉਹ ਵੀ ਪੀ ਜੀ ਬਹੁਤ ਵਧੀਆ ਉੱਥੇ ਉੱਥੇ ਨੇੜੇ ਤੇੜੇ ਹੈਗਾ ਐਕਸਲ ਹੋਸਪੀਟਲ ਹਾਂ ਅਤੇ ਐਕਸਲ ਹੋਸਪੀਟਲ ਦੇ ਵੀ ਨਾਲ ਜਮਾਂ ਉਥੇ ਹੈਗਾ ਉਹਦੇ ਨੇੜੇ ਤੇੜੇ ਤਿੰਨ ਚਾਰ ਪੀ ਜੀ ਨੇ ਇੱਕ 'ਚ ਤਾਂ ਹੈਗਾ ਤੁਹਾਨੂੰ ਖਾਣ ਪੀਣ ਵੀ ਵਿੱਚੇ ਮਿਲ ਜੂਗਾ ਹਾਂ ਅਤੇ ਖਾਣ ਪੀਣ ਵੀ ਵਿੱਚੇ ਮਿਲ ਜੂਗਾ ਤੁਹਾਨੂੰ ਅਤੇ ਬਾ ਉਹਦੇ ਵਿੱਚ ਬਿਜਲੀ ਦਾ ਬਿੱਲ ਸਾਰਾ ਅੱਡ ਹੋਊਗਾ ਅਤੇ ਇਹ ਹੀ ਹੈ ਬਾਕੀ ਤਾਂ ਸਾਰਾ ਹੋਰ ਤਾਂ ਬਾਕੀ ਰਹਿਣ ਸਹਿਣ ਦੀ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਸਾਰੇ ਪੀ ਜੀ ਵਧੀਆ ਨੇ ਉਸ ਇਲਾਕੇ ਦੇ ਬਾਕੀ ਤੁਹਾਨੂੰ ਮਿਲ ਲਿਓ ਮੈਨੂੰ ਦੋ ਤਿੰਨ ਜਣੇ ਪਰਸਨਲੀ ਜਾਣਦੇ ਨੇ ਮੈਂ ਤੁਹਾਨੂੰ ਲੈ ਜੂੰਗਾ ਉਹਨਾ ਕੋਲ ਮੈਂ ਤੁਹਾਡੀ ਆਪੇ ਗੱਲ ਕਰਵਾ ਦੂੰਗਾ ਉਹਨਾਂ ਕੋਲੇ ਹਾਂ ਉਹਨਾ ਨਾਲ ਗੱਲ ਰੇਟ ਫਿਕਸ ਕਰ ਲਾਂਗੇ ਕੋਈ ਨਹੀਂ ਮੇਰੀ ਜਾਣ ਪਛਾਣ ਹੈਗੀ ਹੈ ਉਹਨਾ ਨਾਲ ਅਤੇ ਤੁਹਾਨੂੰ ਵਧੀਆ ਰੇਟ ਦੇ ਦੇਣਗੇ ਉਹ ਠੀਕ ਹੈ ਬਾਕੀ ਕੋਈ ਦਿੱਕਤ ਹੋਈ ਮੈਨੂੰ ਦੱਸ ਦਿਓ ਆਪਾਂ ਉਵੇਂ ਸੈੱਟ ਕਰਲਾਂਗੇ ਬਾਕੀ ਮੈਨੂੰ ਮਿਲ ਲਿਉ ਤੁਸੀਂ ਮੈੈਂ ਵੀ ਯੂਨੀਵਰਸਿਟੀ ਹੀ ਹਾਂ ਹੁੰਦਾ ਹਾਂ ਚਲੋ ਠੀਕ ਹੈ ਵੀਰੇ ਫਿਰ